ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜਗਬਾਣੀ ਤੋਂ ਸਵਰਨਜੀਤ ਕੌਰ ਪੱਤਰਕਾਰ ਬੋਲਦੀ ਆਂ ਹਾਂਜੀ ਅਸੀਂ ਪੁੱਛਣਾ ਸੀ ਵੀ ਜਿਹੜੇ ਜਾਂ ਹਾਂਜੀ ਐਕਸੀਡੈਂਟ ਹੋਇਆ ਬੱਸ ਦਾ ਮੇਲ ਵਾਲੀ ਹਾਂਜੀ ਤੇ ਉਹ ਕੀ ਵੀ ਕਿਵੇਂ ਵਈ ਹੋਇਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹੂੰ ਹੂੰ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਇਹ ਪੁੱਛਣਾ ਚਾਹੁੰਨੀ ਆਂ ਵੀ ਸੁਆਰੀਆਂ ਕਿੰਨੀਆਂ ਸੀ ਵਿੱਚ ਹਾਂਜੀ ਹਾਂਜੀ ਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਬਹੁਤ ਮਾੜੀ ਗੱਲ ਹੋਈ

ਕਿਓਂ ਪਤਾ ਨੀ ਲੱਗਾ ਤੁਆਨੂੰ ਵੀ ਸੁਆਰੀਆਂ ਕਿੰਨੀਆਂ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਮਾੜਾ ਬਹੁਤ ਹਾਂਜੀ ਹਾਂਜੀ ਹਾਂਜੀ ਨਹਿਰ ਭਰੀ ਵੀ ਸੀ ਹਾਂਜੀ ਬੱਚੇ ਵੀ ਹੋਣਗੇ ਹਾਂਜੀ ਹਾਂਜੀ ਬਹੁਤ ਮਾੜੀ ਗੱਲ ਹੋਈ ਹਾਂਜੀ ਹਾਂਜੀ ਤੇ ਵੀ ਸਾਨੂੰ ਹਾਂਜੀ ਠੀਕ ਐ ਸਾਨੂੰ ਦੱਸਿਓ ਵੀ ਜਦੋਂ ਵੀ ਕੋਈ ਹੋਰ ਦੱਸਿਓ ਵੀ ਕਿੰਨੀਆਂ ਸੁਆਰੀਆਂ ਦੀ ਬੱਚਤ ਹੋਗੀ ਤੇ ਕਿੰਨੀਆਂ ਦੀ ਵਿੱਚ ਡੁੱਬਗੀਆਂ ਹਾਂਜੀ ਵੱਧ ਤੋਂ ਵੱਧ ਗ ਹਾਂਜੀ ਦੱਸੋ ਠੀਕ ਐ